ਪਿਛਲੇ ਕਈ ਸਾਲਾਂ ਤੋਂ ਭਾਰਤ ਦੇ ਅਰਥਚਾਰੇ ਅਤੇ ਵਿਕਾਸ ਵਿੱਚ ਕਾਫੀ ਯੋਗਦਾਨ ਆਇਆ ਹੈ ਅਤੇ ਜਿਸ ਵਿੱਚ ਕਈ ਫੈਕਟਰੀਆਂ ਅਤੇ ਇੰਡਸਟਰੀਅਲ ਫੈਕਟਰੀਆਂ ਦਾ ਵੀ ਪੂਰਾ ਯੋਗਦਾਨ ਹੈ ਜਿਸ ਨਾਲ ਕਿ ਪੰਜਾਬ ਦਾ ਪੈਸਾ ਬਾਹਰ ਆਇਆ ਹੈ ਜਿਸ ਨਾਲ ਕਿ ਇਹ ਡਿਜ਼ੀਟਲ ਭੁਗਤਾਨ ਹੋ ਹੋਣਾ ਸ਼ੁਰੂ ਹੋਇਆ ਅਤੇ ਇਸ ਨਾਲ ਪੰਜਾਬ ਦੀ ਆਰਥਿਕ ਸਥਿਤੀ ਕਾਫੀ ਜ਼ਿਆਦਾ ਇੰਪਰੂਵ ਹੋਈ ਹੈ ਅਤੇ ਲੋਕ ਜ਼ਿਆਦਾ ਕੈਸ਼ ਪੈਸਿਆਂ ਦੇ ਭੁਗਤਾਨ ਨਾਲੋਂ ਡਿਜ਼ੀਟਲ ਭੁਗਤਾਨ ਜ਼ਿਆਦਾ ਕਰਨਾ ਪਸੰਦ ਕਰਦੇ ਹਨ